ਹਾਂਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਕਰ ਸਕਦੇ ਹਾਂ ਤੁਹਾਡੀ ਹੈਲਪ ਜਦੋਂ ਵੀ ਤੁਸੀਂ ਸ਼ਹਿਰ ਦੇ ਵਿੱਚ ਆਉਣਾ ਹੋਵੇ ਤੁਸੀਂ ਮੈਨੂੰ ਦੱਸ ਦਿਆ ਜੇ ਤੁਹਾਡੇ ਵਾਸਤੇ ਅਸੀਂ ਆਪਦੇ ਮਹੱਲੇ ਦੇ ਵਿੱਚ ਹੀ ਕੋਈ ਰੈਂਟ 'ਤੇ ਮਕਾਨ ਵੀ ਲੈ ਦਿਆਂਗੇ ਬੱਚਿਆਂ ਦੀ ਐਡਮਿਸ਼ਨ ਅਗਰ ਕਿਸੇ ਸਕੂਲ 'ਚ ਕਰਵਾਉਣੀ ਹੋਵੇ ਬਹੁਤ ਹੀ ਵਧੀਆ ਸਕੂਲ ਹਨ ਫਜ਼ਿਲਕਾ ਦੇ ਵਿੱਚ ਆਰਮੀ ਸਕੂਲ ਹੈ ਸੈਕਰਟ ਆਰਟ ਸਕੂਲ ਹੈ ਸਰਵਿਤਕਾਰੀ ਸਕੂਲ ਹੈ ਬੋਇਸ ਸਕੂਲ ਹੈ ਸੀਨੀਅਰ ਸੈਕੈਂਡਰੀ ਸਕੂਲ ਬੱਚਿਆਂ ਦੇ ਪਲੱਸ ਵਨ ਟੂ ਵਾਲਾ ਇਸੇ ਤਰਾਂ ਲੜਕੀਆਂ ਦਾ ਪਲੱਸ ਵਨ ਟੂ ਸਿਕਸ ਤੋਂ ਲੈ ਕੇ ਪਲੱਸ ਵਨ ਟੂ ਤੱਕ ਲੜਕੀਆਂ ਦਾ ਸਕੂਲ ਹੈ ਜਿੱਥੇ ਮੈਡੀਕਲ ਨੋਨ ਮੈਡੀਕਲ ਸਾਰੀਆਂ ਹੀ ਸਹੂਲਤਾਂ ਹਨ ਇਸ ਤੋਂ ਇਲਾਵਾ ਫਾਜ਼ਿਲਕਾ ਦੇ ਵਿੱਚ ਆਪਣੇ ਡਾਕਟਰ ਵੀ ਬਹੁਤ ਅੱਛੇ ਬੜੇ ਸਿਆਣੇ ਸੂਝਵਾਨ ਡਾਕਟਰ ਹਨ ਜਿਹੜੇ ਕਿ ਬਹੁਤ ਹੀ ਵਧੀਆ ਸੇਵਾਵਾਂ ਦੇ ਰਹੇ ਹਨ ਤੁਸੀਂ ਜਦੋਂ ਮਰਜ਼ੀ ਆਓ ਇੱਥੇ ਮੋਸਟ ਵੈਲਕਮ ਫਾਜਿਲਕਾ ਸ਼ਹਿਰ ਬਹੁਤ ਸਾਫ ਸੁਥਰਾ ਨੀਟ ਐਂਡ ਕਲੀਨ ਸ਼ਹਿਰ ਹੈ ਇਸ 'ਤੇ ਕੋਈ ਲੜਾਈ ਝਗੜਾ ਕਿਸੇ ਤਰ੍ਹਾਂ ਦੀ ਕੋਈ ਹਿੰਸਾ ਕਿਸੇ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਇੱਥੇ ਹਾਂਜੀ ਹਾਂ ਹਾਂ ਹਾਂ ਹਾਂ ਹਾਂ ਬੱਚਿਆਂ ਨੂੰ ਜਿੱਥੇ ਵੀ ਐਡਮਿਸ਼ਨ ਦਲਾਉਣੀ ਹੋਵੇ ਜਿਹੜੇ ਵੀ ਸਕੂਲ 'ਚ ਵੈਣਾ ਲੱਗੀਆਂ ਹੋਈਆਂ ਨੇ ਸਭ ਮੈਨੂੰ ਚਾਲੀ ਸਾਲ ਹੋ ਗਏ ਇਸ ਸ਼ਹਿਰ ਦੇ ਵਿੱਚ ਰਹਿੰਦੇ ਨੂੰ ਅਤੇ ਤੁਸੀਂ ਜਦੋਂ ਵੀ ਆਓ ਮੋਸਟ ਵੈਲਕਮ ਤੁਹਾਡੀ ਪੂਰੀ ਹੈਲਪ ਕਰਾਂਗੇ ਅਸੀਂ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਐਜੂਕੇਸ਼ਨ ਜਿਹੜੀ ਨਾ ਬਹੁਤ ਚੰਗੀ ਹੁੰਦੀ ਹੈ ਬੱਚੇ ਉਹ ਪਿੰਡ ਦੇ ਵਿੱਚ ਉੱਨੀ ਐਜੂਕੇਸ਼ਨ ਉੱਨੀ ਫੈਸਿਲਿਟੀ ਪਿੰਡਾਂ ਦੇ ਵਿੱਚ ਨਹੀਂ ਮਿਲਦੀ ਜਿਹੜੀ ਕਿ ਜਿਹੜੀ ਕਿ ਸ਼ਹਿਰਾਂ ਦੇ ਵਿੱਚ ਮਿਲਦੀ ਹੈ ਮਿਊਜਿਕ ਵੀ ਬਹੁਤ ਅੱਛੇ ਟੀਚਰ ਹਨ ਟੂਸ਼ਨ ਵੀ ਬੱਚਿਆਂ ਦੀ ਬਹੁਤ ਵਧੀਆ ਵਧੀਆ ਲੈਕਚਰਾਰ ਇੱਥੇ ਹਨ ਸ਼ਹਿਰਾਂ ਦੇ ਬਹੁਤ ਹੀ ਫਾਇਦੇ ਹਨ ਬਹੁਤ ਹੀ ਵਧੀਆ ਡਾਕਟਰ ਵੱਡੇ ਵੱਡੇ ਕਲੀਨਿਕ ਬੜਾ ਵਧੀਆ ਹੋਸਪਿਟਲ ਪਿੰਡਾਂ ਦੇ ਵਿੱਚ ਹਾਂ ਤੁਸੀਂ ਜਲਦੀ ਤੋਂ ਜਲਦੀ ਜਦੋਂ ਵੀ ਆਉਣਾ ਹੋਵੇ ਮੈਨੂੰ ਦੱਸ ਦਿਓ ਤੁਹਾਨੂੰ ਇੱਥੇ ਕਿਰਾਏ 'ਤੇ ਲੈ ਦਿਆਂਗੇ ਅਤੇ ਬਹੁਤ ਵਧੀਆ ਹਾਂਜੀ ਤੁਸੀਂ ਇਥੇ ਸੈਟ ਹੋ ਜਾਓਗੇ